ਹੈਲੋ ਹਾਂਜੀ ਸਰ ਲਾਸਟ ਵੀਕ ਮੈਂ ਪ੍ਰੇਮ ਲਤਾ ਜੀ ਦੇ ਨਾਂ 'ਤੇ ਇਨਸ਼ੋਰੈਂਸ ਕਲੇਮ ਦੇ ਬਿੱਲ ਸਬਮਿਟ ਕਰਵਾਏ ਸੀ ਸਰ ਉਹਦੇ ਵਿੱਚ ਸਰ ਮੈਂ ਉਹਨਾਂ ਦੇ ਮੈਡੀਕਲ ਬਿਲਸ ਮੈਡੀਸਨਸ ਦੇ ਬਿਲਸ ਡਿਸਚਾਰਜ ਸਲਿਪ ਔਰ ਉਹਨਾਂ ਦੇ ਐਕਸਰੇਜ ਵਗੈਰਾ ਸਾਰੇ ਸਬਮਿਟ ਕਰਵਾਏ ਸੀ ਸਰ ਅਤੇ ਉਹਦੇ ਕਲੇਮ ਦੇ ਬਾਰੇ 'ਚ ਮੈਂ ਪੁੱਛਣਾ ਚਾਹੁੰਦਾ ਸੀ ਕਿ ਉਹਦੀ ਕੀ ਪ੍ਰੋਗਰੈਸ ਹੈ ਅਤੇ ਕਿੱਥੇ ਕੇ ਕੇਸ ਹੈ ਸਰ ਔਰ ਲਾਸਟ ਵੀਕ ਮੇਰੀ ਗੱਲ ਹੋਈ ਸੀ ਤੁਹਾਡੇ ਐਗਜੀਗੇਟਿਵ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਦੋ ਦਿਨ ਬਾਅਦ ਕਾਲ ਕਰ ਲਿਓ ਤਾਂ ਇਸ ਕਰਕੇ ਮੈਂ ਸਰ ਤੁਹਾਨੂੰ ਕਾਲ ਕੀਤੀ ਹੈ ਉਹਨਾਂ ਦਾ ਸਾਰੇ ਜਿਹੜੇ ਵੀ ਬਿੱਲ ਸੀ ਉਹ ਮੈਂ ਤੁਹਾਨੂੰ ਮੇਲ ਵੀ ਕਰ ਦਿੱਤੇ ਸੀ ਅਤੇ ਤੁਹਾਡੇ ਐਗਜੀਕਿਟਵ ਨੂੰ ਵਟਸਐਪ 'ਤੇ ਵੀ ਭੇਜ ਦਿੱਤੇ ਸੀ ਸਰ ਜੈਸ